ਸਤਿ ਸ਼੍ਰੀ ਅਕਾਲ ਜੀ ਜੀ ਮੇਰਾ ਔਡਰ ਨੰਬਰ ਅੱਠ ਸੌ ਪੰਜਾਹ ਥੋੜ੍ਹੀ ਦੇਰ ਪਹਿਲੇ ਮੈਂ ਤੁਹਾਡੇ ਔਡਰ ਕੀਤਾ ਸੀ ਤੁਹਾਡੇ ਰੈਸਟੋਰੈਂਟ ਤੋਂ ਦੋ ਬਰਗਰ ਤਿੰਨ ਪੀਜ਼ੇ ਅਤੇ ਦੋ ਕੋਲਡ ਡਰਿੰਕ ਸੀ ਪਰ ਕਿਸੇ ਕਾਰਨ ਓਜ ਮੈਨੂੰ ਅ ਕਿੱਥੇ ਜਾਣਾ ਪੈ ਰਿਹਾ ਏ ਐਮਰਜੈਂਸੀ ਅਤੇ ਮੈਂ ਆਪਣਾ ਇਹ ਔਡਰ ਕੈਂਸਲ ਕਰ ਰਹੀ ਆ ਕਿਰਪਾ ਸਹਾਇਤਾ ਕਰੋ ਧੰਨਵਾਦ